ਇੱਕ ਕਾਬਿਲ ਇਨਸਾਨ ਬਣਨ ਦੇ ਲਈ ਅਤੇ ਸਮਾਜ ਵਿੱਚ ਵਿਚਰਨ ਦੇ ਲਈ ਜਿੰਨੀ ਐਜੂਕੇਸ਼ਨ ਦੀ ਬੱਚੇ ਨੂੰ ਜਰੂਰਤ ਹੈ ਉਨੀ ਅਸੀਂ ਜਰੂਰ ਪ੍ਰੋਵਾਈਡ ਕਰਵਾਉਣਾ ਚਾਹਾਂਗੇ